ਪੰਜਾਬ ਵਿੱਚ ਵੱਖ ਵੱਖ ਭਾਈਚਾਰਕ ਜਿਹੜੀ ਸਾਂਝ ਹੈ ਬੜੇ ਵਧੀਆ ਤਰੀਕੇ ਨਾਲ ਸਾਡੇ ਤਾਂ ਚੱਲ ਹੀ ਰਹੀ ਹੈ ਸ ਪਹਿਲਾਂ ਹੀ ਗੁਰੂ ਸਾਹਿਬਾਨਾਂ ਦੇ ਸਮਾਂ ਤੋਂ ਹੁਣ ਵੀ ਜਦੋਂ ਕੋਈ ਕੋਈ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੁੰਦਾ ਚਾਹੇ ਉਹ ਧਾਰਮਿਕ ਹੋਵੇ ਜਾਂ ਸਮਾਜਿਕ ਉਸ ਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ ਉਹ ਚਾਹੇ ਅਸੀਂ ਪਾਠ ਕਰਾ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਾਂ ਕੋਈ ਗੀਤਾ ਦਾ ਪਾਠ ਕਰਾ ਲਵੇ ਜਾਂ ਕੋਈ ਕੁਰਾਨ ਸ਼ਰੀਫ ਦਾ ਪਾਠ ਕਰਾ ਲਵੇ ਤਾਂ ਸਾਰੇ ਜਿਹੜੇ ਭਾਈਚਾਰਕ ਜਿਹੜੀ ਸਾਂਝ ਹੈ ਉਹ ਬਣੀ ਰਹਿੰਦੀ ਹੈ ਪੰਜਾਬ ਵਿੱਚ ਲੋਕ ਇੱਕ ਦੂਸਰੇ ਨਾਲ ਇਸ ਤਰੀਕੇ ਨਾਲ ਹਰ ਧਰਮ ਦਾ ਬੰਦਾ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ ਅਤੇ ਉੱਥੇ ਉਹ ਉਹ ਜਾਂਦਾ ਵੀ ਹੈ